ਪਿਛਲੇ ਸਮੇਂ ਦੇ ਮੁਕਾਬਲੇ ਵਿੱਚ ਹੁਣ ਕਾਫੀ ਜ਼ਿਆਦਾ ਵਿਕਾਸ ਹੋਇਆ ਹੈ ਸਾਡੇ ਖੇਤਰ ਦੇ ਵਿੱਚ ਜਿਹੜੇ ਜੋ ਪਹਿਲਾਂ ਕੱਚਾ ਕੱਚੀ ਸੜਕਾਂ ਵਗੈਰਾ ਹੁੰਦੀਆਂ ਸੀ ਉਹ ਕਾਫੀ ਪੱਕੀਆਂ ਉਹ ਪੱਕੀਆਂ ਹੋ ਚੁੱਕੀਆਂ ਹਨ ਮੇਨ ਤੌਰ 'ਤੇ ਜਿਹੜਾ ਸਾਡਾ ਇਹ ਖੇਤਰ ਹੈ ਇਸ ਖੇਤਰ ਵਿੱਚ ਸਾਡੇ ਮਹਾਰਾਜਾ ਪਟਿਆਲਾ ਦੇ ਘਰਾਨੇ ਵੱਲੋਂ ਰਾਜ ਕੀਤਾ ਗਿਆ ਜਿਹਨਾਂ ਵੱਲੋਂ ਕਾਫੀ ਜ਼ਿਆਦਾ ਉਸ ਆਪਣੇ ਸਮੇਂ ਵਿੱਚ ਵਿਕਾਸ ਕੀਤਾ ਗਿਆ ਹੈ